ਪੰਜਾਬ ਵਿੱਚ ਵਿਦਿਆਰਥੀਆਂ ਨੂੰ ਜਿਹੜਾ ਕਰੀਅਰ ਅਤੇ ਸਿੱਖਿਆ ਦੇ ਮੌਕੇ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਮਿਲਦੇ ਹਨ ਜਿਵੇਂ ਕਿ ਹਾਲ ਹੀ 'ਚ ਮੈਂ ਦੇਖਿਆ ਸੀ ਕਿ ਛੇਵੀਂ ਕਲਾਸ ਦੇ ਬੱਚਿਆਂ ਨੂੰ ਵੀ ਅੱਜ ਕੱਲ ਆਰਟੀਫਿਸ਼ਅਲ ਇੰਟੈਲੀਜੈਂਸ ਤੇ ਨਵੀਂ ਨਵੀਂ ਤਕਨੀਕੀ ਦੀ ਜਿਹੜੀ ਸਿੱਖਿਆ ਉਹ ਦਿੱਤੀ ਜਾਂਦੀ ਹੈ ਜਿਸ ਕਰਕੇ ਜਿਹੜੀ ਸਾਡੀ ਦੇਸ਼ ਦੀ ਬੜੀ ਬੜੀ ਕੰਪਨੀਆਂ ਹਨ ਜਿੱਦਾਂ ਇਨਫੋਸਿਸ ਹੈ ਵਿਪਰੋ ਹੈ ਉਹ ਆਪਣੇ ਨੌਰਥ ਅਤੇ ਪੰਜਾਬ ਦੇ ਜਿਹੜੇ ਲੋਕਾਂ ਨੂੰ ਲਿਜਾਣਾ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਹਾਲ ਹੀ 'ਚ ਚੰਡੀਗੜ੍ਹ 'ਚ ਵੀ ਇੱਕ ਇਨਫੋਸਿਸ ਦਾ ਆਈਟੀ ਪਾਰਕ ਖੁੱਲ ਗਿਆ ਹੈ ਉਹਨਾਂ ਨੇ ਆਪਣੀ ਜਿਹੜੀ ਮੇਨ ਬਰਾਂਚ ਹੈ ਉਹ ਮੋਹਾਲੀ ਦੇ ਕੁਛ ਖੇਤਰਾਂ 'ਚ ਬਣਾਈ ਗਈ ਹੈ ਜਿਸ ਤੋਂ ਆਪਾਂ ਸਪੋਰਟ ਵਰਗੇ ਜਿਹੜੇ ਕੰਮ ਹੈ ਉਹ ਦਿੱਤੇ ਜਾਂਦੇ ਹਨ ਇਸ ਤਰੀਕੇ ਨਾਲ ਜਿਹੜਾ ਪੰਜਾਬ ਹੈ ਉਹ ਸਿੱਖਿਆ ਅਤੇ ਪ੍ਰਣਾਲੀ ਵਿਵਸਥਾ ਨੂੰ ਵਧੀਆ ਤਰੀਕੇ ਨਾਲ ਕਰ ਰਿਹਾ ਹੈ